ਮੇਰੇ ਕੋਲ ਆਪਣੀ ਪਸੰਦ ਦਾ ਕਲਾਕਾਰ ਡਰਾਇੰਗ ਨਾਲ ਸਬੰਧਿਤ ਹੈ ਜਿਨ੍ਹਾਂ ਦੇ ਕੰਮ ਨੂੰ ਦੇਖ ਕੇ ਮੈਂ ਬਹੁਤ ਪ੍ਰਭਾਵਿਤ ਹੁੰਦੀ ਹਾਂ ਮੈਂ ਉਸਦੇ ਡਰਾਇੰਗ ਦੀਆਂ ਅਲੱਗ ਅਲੱਗ ਕ੍ਰਿਤੀਆਂ ਦੇ ਕੰਮ ਨੂੰ ਦੇਖਣਾ ਪਸੰਦ ਕਰਦੀ ਹਾਂ ਮੈਂ ਉਹਨਾਂ ਦੇ ਕੰਮ ਨੂੰ ਦੇਖ ਦੇਖ ਕੇ ਖੁਦ ਸਿੱਖਦੀ ਹਾਂ ਮੈਂ ਇਹਨਾਂ ਤੋਂ ਹਰ ਸਮੇਂ ਦੀ ਜਾਣਕਾਰੀ ਲੈਂਦੀ ਰਹਿੰਦੀ ਹਾਂ ਅਤੇ ਉਹ ਜਾਣਕਾਰੀ ਦਾ ਅਭਿਆਸ ਕਰਦੀ ਰਹਿੰਦੀ ਹਾਂ ਮੈਨੂੰ ਜੋ ਕੁਝ ਪਤਾ ਨਹੀਂ ਲੱਗਦਾ ਤਾਂ ਮੈਂ ਆਪਣੇ ਡਰਾਇੰਗ ਕਲਾਕਾਰ ਨੂੰ ਨਾਲ ਸਲਾਹ ਕਰਦੀ ਹਾਂ ਅਤੇ ਉਹਨਾਂ ਤੋਂ ਸਿੱਖਦੀ ਹਾਂ ਫਿਰ ਉਹ ਚੀਜ਼ ਦਾ ਅਭਿਆਸ ਕਰਦੀ ਰਹਿੰਦੀ ਹਾਂ